ਹੈਲੋ ਯੂ ਐਂਡ ਮੀ ਮੈਂ ਅਕਸਰ ਤੁਹਾਡੇ ਤੋਂ ਤੁਹਾਡੇ ਹੀ ਆਡਰ ਕਰਦੀ ਹੁੰਦੀ ਹਾਂ ਕਿਉਂਕਿ ਮੈਨੂੰ ਤੁਹਾਡਾ ਟੇਸਟ ਅਤੇ ਤੁਹਾਡੀ ਸੇਵਾ ਬਹੁਤ ਵਧੀਆ ਲੱਗਦੀ ਹੈ ਅਤੇ ਹਫਤਾ ਪਹਿਲਾਂ ਮੈਂ ਨਿਊਡਲਸ ਆਲੂ ਟਿੱਕੀ ਅਤੇ ਦਹੀਂ ਭੱਲੇ ਔਡਰ ਕੀਤੇ ਸਨ ਜੋ ਮੈਨੂੰ ਬਹੁਤ ਜ਼ਿਆਦਾ ਪਸੰਦ ਆਏ ਹਨ ਅਤੇ ਅੱਜ ਮੈਂ ਉਹੀ ਔਡਰ ਦੁਬਾਰਾ ਰਪੀਟ ਕਰਨਾ ਚਾਹੁੰਦੀ ਹਾਂ ਕਿਉਂਕਿ ਸਾਡੇ ਘਰੇ ਰਿਸ਼ਤੇਦਾਰਾਂ ਨੇ ਆਉਣਾ ਹੈ ਅਤੇ ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਅਸੀਂ ਉਹਨੂੰ ਬਣਾ ਸਕੀਏ ਤਾਂ ਮੈਂ ਚਾਹੁੰਦੀ ਹਾਂ ਕਿ ਜੋ ਔਡਰ 'ਤੇ ਮੈਂ ਪਹਿਲਾਂ ਕੀਤਾ ਸੀ ਤੁਸੀਂ ਉਹਨੂੰ ਹੀ ਦੁਹਰਾਓ ਅਤੇ ਆਪਣੀ ਲਿਸਟ ਚੈੱਕ ਕਰਕੇ ਮੈਨੂੰ ਸਾਰਾ ਔਡਰ ਉਵੇਂ ਹੀ ਭੇਜ ਦਿਓ ਅਤੇ ਵਿੱਚ ਫਰੂਟੀ ਵੀ ਐਡ ਕਰ ਦਿਓ ਤਾਂ ਜੋ ਅਤੇ ਮੈਂ ਚਾਹੁੰਨੀ ਹਾਂ ਕਿ ਸਾਰੀਆਂ ਚੀਜ਼ਾਂ ਦਾ ਟੇਸਟ ਉਵੇਂ ਹੋਵੇ ਅਤੇ ਤੁਹਾਡੀ ਜੋ ਸਰਵਿਸ ਆ ਉਹ ਬਹੁਤ ਫਾਸਟ ਆ ਅਤੇ ਮੈਂ ਚ ਸਾਡੇ ਰਿਸ਼ਤੇਦਾਰਾਂ ਨੇ ਘੰਟੇ ਤੱਕ ਆਉਣਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਅੱਧੇ ਘੰਟੇ ਤੱਕ ਮੇਰੇ ਕੋਲ ਔਡਰ ਪਹੁੰਚ ਜਾਵੇ ਧੰਨਵਾਦ